ਹਾਂਜੀ ਨਮਸਕਾਰ ਜੀ ਹਾਂਜੀ ਹਾਂ ਮੀਡਿਆ ਪ੍ਰੇੱਸ ਤੋਂ ਗੱਲ ਕਰ ਰਿਹਾ ਜੀ ਹਾਂਜੀ ਆਪਾਂ ਤੁਹਾਡੇ ਤੋਂ ਐਜੂਕੇਸ਼ਨ ਬਾਰੇ ਜਾਣਕਾਰੀ ਲੈਣੀ ਸੀ ਤੋਹਾਤੇ ਹਾਂਜੀ ਹਾਂਜੀ ਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਜੀ

ਇਹ ਜਿਹੜੇ ਪ੍ਰਾਈਮਰੀ ਸਕੂ ਪ੍ਰਾਇਮਰੀ ਸਿੱਖਿਆ ਦ ਦੇ ਬਾਰੇ ਤੁਸੀਂ ਕਿੱਥੋਂ ਤੱਕ ਜ ਜਾ ਜਾਣਦੇ ਹੋ ਜਿਵੇਂ ਕਿ ਅੱਜ ਕੱਲ ਬ ਬੱਚੇ ਨੂੰ ਸਕੂ ਸਕੂਲ 'ਚ ਡਾਇਟ ਵਗੈਰਾ ਵੀ ਦਿੱਤੇ ਦਿੱਤੀ ਜਾਂਦੀ ਹੈ ਸਕੂਲਾਂ 'ਚ ਅਤੇ ਬੱਚੇ ਹਾਂ ਹਾਂ ਹਾਂ ਜੀ ਉਸ ਦੇ ਬਾਰੇ ਤੁਹਾਡਾ ਨੋ ਨੋਲਜ ਵੀ ਕਿਸ ਤਰ੍ਹਾਂ ਦਾ ਖਾਣਾ ਪ੍ਰੋਵਾਈਡ ਹੋ ਰਿਹਾ ਜੀ ਕਿਸ ਤਰ੍ਹਾਂ ਜੀ ਜੀ ਜੀ ਜੀ ਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਇਹੋ ਬਾਰੇ ਇੱਥੇ ਖੇ ਖੇਡਾਂ ਬਾਰੇ ਵੀ ਕੋਈ ਪ੍ਰਫੁੱਲਿਤ ਕਰ ਰਹੇ ਨੇ

ਬਿਲਕੁਲ ਜੀ ਬਿਲਕੁਲ ਹਾਂ ਹਾਂਜੀ ਬਿਲਕੁਲ ਕੋਈ ਇੱਥੇ ਪਰ ਜਿਸ ਤਰ੍ਹਾਂ ਸੁਬਾ ਦੀ ਸੁਬਾ ਦੀ ਪਰੇਅਰ ਹੋਰ ਹੁੰਦੀ ਹੈ ਉਸ ਵਿੱਚ ਕੋਈ ਸਪੈਸ਼ਲ ਕੋਈ ਬੱਚਿਆਂ ਨੂੰ ਕੋਈ ਟੋਪਿਕ ਦੇ ਰਹੇ ਹੋ ਜੀ ਜੀ ਹਾਂਜੀ ਜੀ ਜੀ ਬਿਲਕੁਲ ਜੀ ਹਾਂ ਤੁਹਾਡੇ ਹਿਸਾਬ ਤੋਂ ਬਹੁਤ ਵਧੀਆ ਇਸ ਟਾਈਮ ਐਜੁਕੈਸ਼ਨ ਦਾ ਢਾਂਚਾ ਬਹੁਤ ਠੀਕ ਚੱਲ ਰਿਹਾ ਹੈਗਾ ਹਾਂ ਆਪਣੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ ਆਪਦਾ ਬਹੁਤ ਬਹੁਤ ਸ਼ੁਕਰੀਆ ਹਾਂਜੀ